ਭੰਗੜਾ ਮ ਐਰੋਬਿਕ ਮੁਕਾਬਲੇ ਹਰ ਹਰ ਬਲ ਸ਼ਹਿਰ ਹਰ ਦੇਸ਼ ਦੇ ਵਿੱਚ ਅਲੱਗ ਅਲੱਗ ਹਨ ਪੰਜਾਬ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਇਹ ਅੱਜ ਕੱਲ੍ਹ ਬਹੁਤ ਮਸ਼ਹੂਰ ਹਨ ਪੰਜਾਬੀ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਹਨ ਉਹ ਵੀ ਵਿਦੇਸ਼ੀ ਗਾਣਿਆਂ ਅਤੇ ਵਿਦੇਸ਼ੀ ਸੰਗੀਤ ਦੇ ਨਾਲ ਇਹ ਭੰਗੜਾ ਐਰੋਬਿਕ ਕਰ ਰਹੇ ਹਨ ਜਿਹੜੇ ਵਿਦੇਸ਼ੀ ਹਨ ਜਿਹੜੇ ਵਿਦੇਸ਼ ਵਿੱਚ ਵੱਸਦੇ ਸਾਡੇ ਪੰਜਾਬੀ ਹਨ ਉਹ ਕੁਛ ਪੰਜਾਬੀ ਸੰਗੀਤਾਂ ਅਤੇ ਵਿਦੇਸ਼ੀ ਸੰਗੀਤ ਦੇ ਨਾਲ ਭੰਗੜਾ ਐਰੋਬਿਕ ਕਰ ਰਹੇ ਹਨ ਇਸ ਦੇ ਵੱਖਰੇ ਵੱਖਰੇ ਦੌਰ ਹਰ ਹਰ ਇੱਕ ਹਰ ਇੱਕ ਜਗ੍ਹਾ ਵਿੱਚ ਆਪਣੀ ਤਰ੍ਹਾਂ ਹੀ ਸੈਟ ਕਰਦੇ ਹਨ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਹਨ ਉਹ ਇਹਦੇ ਵਿੱਚ ਉਹਨਾਂ ਨੂੰ ਚਾਹੇ ਸੰਗੀਤ ਦਾ ਕੁਝ ਪਤਾ ਨਹੀਂ ਲੱਗ ਰਿਹਾ ਪਰ ਇਸ ਦੀ ਭੇੜ ਚਾਲ ਬਣੀ ਹੋਈ ਹੈ ਹਰ ਕੋਈ ਇਸ ਨੂੰ ਅਪਣਾ ਰਿਹਾ ਹਰ ਕੋਈ ਇਸ ਦੇ ਪਿੱਛੇ ਲੱਗਾ ਹੋਇਆ ਹਰ ਕੋਈ ਇਸ ਨੂੰ ਅਪਣਾ ਰਿਹਾ ਹੈ ਭੰਗੜਾ ਐਰੋਬਿਕ ਮੁਕਾਬਲੇ ਦਾ ਫ ਫਾਰਮੈਟ ਹਰ ਕੋਈ ਆਪਣੇ ਤਰੀਕੇ ਨਾਲ ਸੈਟ ਕਰ ਰਿਹਾ ਹੈ ਇਸ ਵਿੱਚ ਕਈ ਤਰ੍ਹਾਂ ਦੀਆਂ ਸ਼੍ਰੇਣੀਆਂ ਉਹ ਸ਼ਾਮਿਲ ਕਰ ਰਹੇ ਹਨ ਕੋਈ ਇਸ ਨੂੰ ਰੈਪ ਦੇ ਨਾਲ ਕੋਈ ਪੁਰਾਣੇ ਸੰਗੀਤਾਂ ਦੇ ਨਾਲ ਵਰਤੋਂ ਕਰ ਰਿਹਾ ਹੈ ਧੰਨਵਾਦ